ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੀ ਬਹੁਤ ਮਹੱਤਤਾ ਹੈ ਭੰਗੜਾ ਪੰਜਾਬ ਦੇ ਦੋ ਮੁੱਖ ਲੋਕ ਨਾਚਾਂ ਵਿੱਚੋਂ ਇੱਕ ਹੈ ਭੰਗੜੇ ਦਾ ਇਤਿਹਾਸ ਪੁਰਾਣਾ ਹੈ ਭੰਗੜਾ ਪੰਜਾਬ ਦਾ ਪੁਰਾਣਾ ਲੋਕ ਨਾਚ ਹੈ ਇਹ ਪਹਿਲਾਂ ਵਿਸਾਖੀ ਦੇ ਮੇਲੇ ਭਾਵ ਕਣਕ ਦੀ ਵਾਢੀ ਵੇਲੇ ਕੀਤੀਆਂ ਰੀਤੀ ਰਸਮਾਂ ਸਮੇਂ ਖੁੱਲ੍ਹੇ ਖੇਤਾਂ ਵਿੱਚ ਢੋਲ ਦੇ ਸਾਜ਼ ਨਾਲ ਨੱਚਿਆ ਜਾਂਦਾ ਸੀ ਪਰ ਹੁਣ ਸਮੇਂ ਦੇ ਨਾਲ ਨਾਲ ਭੰਗੜਾ ਹਰ ਖੁਸ਼ੀ ਮੌਕੇ ਜਿਵੇਂ ਕਿ ਬੱਚੇ ਦੇ ਜਨਮ ਸਮੇਂ ਵਿਆਹ ਸਮੇਂ ਜਿੱਤ ਮੌਕੇ ਅਤੇ ਹਰ ਮੇਲੇ ਤਿਉਹਾਰ 'ਤੇ ਪਾਇਆ ਜਾਂਦਾ ਹੈ ਭੰਗੜਾ ਪਾ ਕੇ ਹਰ ਵਿਅਕਤੀ ਆਪਣੀ ਖੁਸ਼ੀ ਜਾਹਿਰ ਕਰਦਾ ਹੈ ਪਹਿਲਾਂ ਭੰਗੜਾ ਇਕੱਲਾ ਢੋਲ ਸਾਜ਼ ਅਤੇ ਬੋਲੀਆਂ ਨਾਲ ਪਾਇਆ ਜਾਂਦਾ ਸੀ ਪਰ ਹੁਣ ਭੰਗੜਾ ਲੋਕ ਗੀਤ